ਮੋਹਾਲੀ ਜ਼ਿਲ੍ਹਾ ਜਿਹੜਾ ਹੈਗਾ ਏ ਉਹਦੇ ਵਿੱਚ ਕਾਫੀ ਜ਼ਿਆਦਾ ਵਿਕਾਸ ਹੋ ਰਿਹਾ ਹੈ ਅਤੇ ਉਹ ਪਹਿਲੇ ਦੇ ਵੀ ਕਾਫੀ ਵਿਕਾਸ ਵਾਲਾ ਜ਼ਿਲ੍ਹਾ ਮੰਨਿਆ ਜਾਂਦਾ ਹੈ ਉੱਥੇ ਜਿਹੜੇ ਜਵਾਨ ਅਤੇ ਬਜ਼ੁਰਗ ਰਹਿੰਦੇ ਨੇ ਉਹ ਕਾਫੀ ਪੜ੍ਹੇ ਲਿਖੇ ਨੇ ਅਤੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈਗੀ ਹੈ ਜਵਾਨਾਂ ਦੀ ਉਹ ਅੱਛੀ ਨੌਕਰੀਆਂ 'ਤੇ ਲੱਗੇ ਹੋਏ ਨੇ ਅੱਛੀ ਪੜ੍ਹਾਈ ਕਰਕੇ ਅਤੇ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਵੀ ਖਾਸ ਕਿਸੇ ਦਿੱਕਤ ਦਾ ਮੁਕਾਬਲਾ ਨਹੀਂ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਨੇ ਉਹ ਆਪਣੇ ਮਾਂ ਬਾਪ ਦੀ ਅੱਛੀ ਦੇਖ ਰੇਖ ਕਰਦੇ ਨੇ ਉਹ ਅੱਛੇ ਇਲਾਜ ਕਰਵਾਉਂਦੇ ਨੇ ਆਪਣੇ ਮਾਂ ਬਾਪ ਦਾ ਜਿਹੜੇ ਨਹੀਂ ਵੀ ਕਰਵਾ ਪਾਉਂਦੇ ਅੱਛੀ ਤਰ੍ਹਾਂ ਜਿਨ੍ਹਾਂ ਕੋਲ ਪੈਸੇ ਦੀ ਕਮੀ ਹੈ ਉਹ ਵੀ ਸਰਕਾਰੀ ਹੋਸ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਕਿਉਂਕਿ ਉੱਥੇ ਬਹੁਤ ਅੱਛੀ ਅੱਛੀ ਫੈਸੀਲਿਟੀਆਂ ਮਿਲਦੀਆਂ ਨੇ ਸਰਕਾਰ ਨੇ ਬਹੁਤ ਸਾਰੇ ਜਿਹੜੇ ਇਲਾਜ ਤੋਂ ਮਿਲਦੇ ਜੁਲਦੇ ਜਿਹੜੇ ਉਹਨਾਂ ਨੇ ਰੱਖੇ ਹੋਏ ਆ ਉਹਨਾਂ ਵਾਸਤੇ ਉਪਕਰਨ ਸਾਰੇ ਉਹਨਾਂ ਦੇ ਵਾਸਤੇ ਬਹੁਤ ਹੀ ਵਧੀਆ ਨੇ ਉਹਨਾਂ ਨੂੰ ਲਾਈਨਾਂ 'ਚ ਨਹੀਂ ਖੜ੍ਹਨਾ ਪੈਂਦਾ ਅਤੇ ਉੱਥੇ ਉਹਨਾਂ ਨੂੰ ਕਾਫੀ ਉਹਨਾਂ ਦੀ ਅੱਛੀ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਜਿਹੜੇ ਕੁਛ ਜਿਹੜੇ ਬੱਚੇ ਹੈਗੇ ਨੇ ਜਿਹੜੇ ਅੱਜ ਕੱਲ੍ਹ ਦੇ ਇਕੱਲੇ ਰਹਿਣਾ ਚਾਹੁੰਦੇ ਨੇ ਉਹ ਆਪਣੇ ਮਾਂ ਬਾਪ ਨੂੰ ਨਾਲ ਨਹੀਂ ਰੱਖਣਾ ਚਾਹੁੰਦੇ ਅਤੇ ਉਹ ਵੀ ਮਾਂ ਬਾਪ ਜਿਹੜੇ ਹੈਗੇ ਨੇ ਬਜ਼ੁਰਗ ਨੇ ਉਹ ਬਿਰਧ ਆਸ਼ਰਮ ਜਿਹੜੇ ਹੈਗੇ ਨੇ ਉੱਥੇ ਜਾ ਕੇ ਬੜੇ ਹੀ ਅੱਛੀ ਸਹਾਇਤਾ ਮਿਲਦੀ ਹੈ ਉਹਨਾਂ ਨੂੰ ਅਤੇ ਉੱਥੇ ਉਹਨਾਂ ਦਾ ਅੱਛਾ ਰੱਖ ਰਖਾਵ ਹੁੰਦਾ ਹੈ ਉਹ ਅੱਛੀ ਤਰੀਕੇ ਨਾਲ ਰਹਿ ਸਕਦੇ ਨੇ